ਬੁਣਾਈ ਅਤੇ ਸਿਲਾਈ ਨੇ ਮੇਰੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਬੁਣਾਈ ਸਿਲਾਈ ਨਾਲ ਮੈਂ ਕਈ ਜੁਰਾਬਾਂ ਕੋਟੀਆਂ ਸਵੈਟਰਾਂ ਬੁਣ ਲੈਂਦੀ ਹਾਂ ਅਤੇ ਕਈ ਪੈ ਅਤੇ ਕਾਫ਼ੀ ਪੈਸੇ ਕਮਾ ਲੈਦੀ ਹਾਂ ਵਧੀਆ ਡਿਜਾਈਨ ਦੇ ਬੁਣਾਈ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜਿੰਨਾ ਜ਼ਿਆਦਾ ਬੁਣਾਈ ਦਾ ਕੰਮ ਕਰਦੀ ਹਾਂ ਓਨਾ ਹੀ ਮੈਂ ਪ੍ਰਭਾਵਿਤ ਹੁੰਦੀ ਹਾਂ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਅਤੇ ਇਸ ਤਰ੍ਹਾਂ ਇਹ ਇੱਕ ਰੁਜ਼ਗਾਰ ਦਾ ਕੰਮ ਹੈ ਜਿਸ ਤਰ੍ਹਾਂ ਜਿਸ ਨਾਲ ਕਾਫ਼ੀ ਪੈਸਾ ਕਮਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਥਰਿੱਡਾਂ ਦੇ ਕੰਮ ਨਾਲ ਕਈ ਵਾਰ ਦਰਦ ਵੀ ਹੋ ਜਾਂਦਾ ਹੈ ਜਿਸ ਕ ਜਿਸ ਨਾਲ ਸਰੀਰਕ ਦਰਦ ਪਿੱਠ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਹ ਉੱਗਲੀਆਂ ਵੀ ਦੁੱਖਣ ਲੱਗ ਜਾਂਦੀਆਂ ਹਨ